ਕਾਨੂੰਨੀ ਮੁੱਦਿਆਂ ਨਾਲ ਨਜਿੱਠਨ ਲਈ ਜਮੀਨ ਦੇ ਨਾਲ ਸੰਬੰਧਿਤ ਝਗੜਿਆਂ ਨੂੰ ਕ ਇਹ ਅਦਾਲਤਾਂ ਲਗਾਈਆਂ ਜਾਂਦੀਆਂ ਨੇ ਕੇਸ ਲਗਾਏ ਜਾਂਦੇ ਹਨ ਜਿਹੜਾ ਜਿਹਦੀ ਮਤ ਜਿਹੜਾ ਕੇਸ ਜਿੱਤ ਜਾਂਦਾ ਵਾ ਉਹਦੇ ਹਵਾਲੇ ਜਮੀਨ ਕੀਤੀ ਜਾਂਦੀ ਆ ਅਤੇ ਉਹਦੇ ਵੱਲ ਹੀ ਕੇਸ ਸਾਰਾ ਉਹ ਉਹ ਕੇਸ ਨੂੰ ਜਿੱਤ ਮਤਲਬ ਕਿ ਜਮੀਨ ਨੂੰ ਜਿੱਤ ਜਾਂਦਾ ਵਾ ਜਿਹੜੇ ਪਰਿਵਾਰਿਕ ਮਾਮਲਿਆਂ ਦੇ ਵਿੱਚ ਜਿਹੜਾ ਪਰਿਵਾਰਿਕ ਆ ਜਿਹੜਾ ਸਹੀ ਪਾ ਪਵਾਰਕ ਪਰਿਵਾਰਿਕ ਹੁੰਦਾ ਵਾ ਉਹਦੇ ਹੋ ਉਹਦੇ ਉਹਦੇ ਵੱਲ ਕੇਸ ਹੋ ਜਾਂਦਾ ਵਾ ਮਤਲਬ ਕਿ ਉਹ ਕੇਸ ਨੂੰ ਜਿੱਤ ਜਾਂਦਾ ਵਾ ਜਿਹੜਾ ਸਹੀ ਹੁੰਦਾ ਵਾ ਜਿਹੜਾ ਮਜ਼ਦੂਰੀ ਆ ਜ਼ਿਆਦਾ ਕੰਮ ਉਹਦੇ ਕੋਲ ਜ਼ਿਆਦਾ ਕੰਮ ਲੈਂਦੇ ਹਨ ਪੇਅ ਉਹਨੂੰ ਪਰ ਤਨਖਾਹ ਘੱਟ ਦਿੰਦੇ ਹਨ ਅਤੇ ਉਹ ਵੀ ਮਜ਼ਦੂਰ ਜਿਹੜਾ ਕਾਨੂੰਨ ਆ ਉਹਦੀ ਉਹਦੀ ਮਦਦ ਕਰਦਾ ਵਾ ਕਰਜ਼ਾ ਜਿਹੜਾ ਉਹ ਕਰਜ਼ਾ ਜ਼ਿਆਦਾ ਲੈਂਦਾ ਉਹ ਮੁੜ ਕੇ ਵਾਪਿਸ ਨਹੀਂ ਕਰਦਾ ਉਹਦੀ ਵੀ ਮਦਦ ਕਾਨੂੰਨ ਹੀ ਕਰਦਾ ਵਾ ਕਾਨੂੰਨ ਜਿਹੜੀ ਆ ਵੀ ਸਾਰਿਆਂ ਮੁੱਦਿਆਂ ਨੂੰ ਸੁਲਝਾਉਣ ਵਿੱਚ ਕੇਸ ਕਰਦੀ ਆ ਅਤੇ ਮਦਦ ਕਰਦੀ ਆ ਹਰੇਕ ਨੂੰ ਸੁਝਾਅ ਦਿੰਦੀ ਆ ਵੀ ਤੁਸੀਂ ਆਹ ਕੇਸ ਇੱਥੇ ਕਰੋ ਆਹ ਕੇਸ ਇੱਥੇ ਕਰੋ ਕਾਨੂੰਨ ਦਾ ਇਸ ਸਾਰੇ ਜਮੀਨੀ ਪਰਿਵਾਰਿਕ ਮਾਮਲਿਆਂ ਮਜ਼ਦੂਰੀ ਕਰਜ਼ੇ ਆਦਿ 'ਤੇ ਜਿਹੜਾ ਵਾ ਵੀ ਉਹਨਾਂ ਦਾ ਮੁੱਦਿਆਂ 'ਤੇ ਜਿਹੜਾ ਸੁਲਝਾਉਣ ਵਿੱਚ ਬਹੁਤ ਹੀ ਯੋਗਦਾਨ ਪਾਇਆ ਜਾਂਦਾ ਵਾ